ਪੰਜਾਬ ਵਿੱਚ ਘੋੜ ਸਵਾਰੀ ਕਰਨ ਦੀਆਂ ਦੋ ਵਿਧੀਆਂ ਮਸ਼ਹੂਰ ਹਨ ਇਸ ਪਹਿਲੀ ਵਿਧੀ ਹੈ ਰੇਵੀਆ ਚਾਲ ਅਤੇ ਦੂਜੀ ਹੈ ਛਪੱਟਾ ਚਾਲ ਰੇਵੀਆ ਚਾਲ ਵਿੱਚ ਘੋੜਾ ਆਰਾਮ ਨਾਲ ਤੁਰਦਾ ਹੈ ਅਤੇ ਰੀ ਛਪੱਟਾ ਚਾਲ ਵਿੱਚ ਘੋੜਾ ਤੇਜ਼ ਤੁਰਦਾ ਹੈ ਮੈਂ ਰੇਵੀਆ ਚਾਲ ਨੂੰ ਵਧੀਆ ਮੰਨਦਾ ਹਾਂ ਕਿਉਂਕਿ ਇਸ ਵਿੱਚ ਘੋੜ ਸਵਾਰ ਲਈ ਵੀ ਸੌਖਾ ਹੁੰਦਾ ਹੈ ਅਤੇ ਘੋੜੇ ਲਈ ਵੀ ਸੌਖਾ ਹੁੰਦਾ ਕਿਉਂਕਿ ਰੇਵੀਆ ਚਾਲ ਵਿੱਚ ਮੈਂ ਲੰਮੀ ਦੂਰੀ ਤੈਅ ਕਰ ਸਕਦਾ ਹਾਂ ਜਦੋਂ ਕਿ ਛਪੱਟਾ ਚਾਲ ਵਿੱਚ ਘੋੜਾ ਤੇਜ਼ ਦੌੜਦਾ ਹੈ ਅਤੇ ਛੇਤੀ ਥੱਕ ਜਾਂਦਾ ਹੈ ਇਸ ਤੋਂ ਇਲਾਵਾ ਛਪੱਟਾ ਚਾਲ ਵਿੱਚ ਘੋੜ ਸਵਾਰ ਨੂੰ ਵੀ ਆਪਣੇ ਆਪ ਨੂੰ ਘੋੜੇ ਉੱਤੇ ਸੰਭਾਲਣਾ ਔਖਾ ਹੋ ਜਾਂਦਾ ਹੈ ਕਿਉਂਕਿ ਘੋੜਾ ਤੇਜ਼ ਰਫਤਾਰ ਵਿੱਚ ਦੌੜਦਾ ਹੈ ਮੈਂ ਰੇਵੀਆ ਚਾਲ ਨੂੰ ਬਿਹਤਰ ਮੰਨਦਾ ਹਾਂ ਕਿਉਂਕਿ ਇਸ ਨਾਲ ਘੋੜੇ ਨੂੰ ਵੀ ਜ਼ਿਆਦਾ ਤਕਲੀਫ ਨਹੀਂ ਹੁੰਦੀ ਅਤੇ ਘੋੜਾ ਵੀ ਲੰਮੀ ਦੂਰੀ ਤੈਅ ਕਰ ਸਕਦਾ ਹੈ ਅਤੇ ਘੋੜ ਸਵਾਰ ਨੂੰ ਲਈ ਵੀ ਬੈਠਣਾ ਸੌਖਾ ਹੁੰਦਾ ਹੈ ਇਸ ਤੋਂ ਇਲਾਵਾ ਘੋੜ ਸਬਾਈ ਕਰਨ ਦੇ ਬਹੁਤ ਫਾਇਦੇ ਹਨ ਕਿਉਂਕਿ ਘੋੜ ਸਵਾਰੀ ਨਾਲ ਘੋੜੇ ਦੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਘੋੜ ਸਵਾਰ ਵੀ ਦੀ ਵੀ ਸਿਹਤ ਠੀਕ ਰਹਿੰਦੀ ਹੈ ਕਿਉਂਕਿ ਘੋੜੇ ਉੱਤੇ ਬੈਠਣਾ ਆਸਾਨ ਨਹੀਂ ਹੁੰਦਾ ਘੋੜ ਸਵਾਰ ਨੂੰ ਵੀ ਆਪਣਾ ਸਰੀਰ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਹੁੰਦਾ ਹੈ ਕਿਉਂਕਿ ਘੋੜ ਸਵਾਰੀ ਕਰਦੇ ਸਮੇਂ ਡਿੱਗਣ ਦਾ ਬਹੁਤ ਡਰ ਹੁੰਦਾ ਹੈ